ਪੈਟਰੋਲ ਦੀ ਵੱਧਦੀਆਂ ਕੀਮਤਾਂ ਨੇ ਮੇਰੀ ਬਾਈਕਿੰਗ ਸ਼ੌਕ ਨੂੰ ਪ੍ਰਭਾਵਿਤ ਕੀਤਾ ਹੈ ਜਦ ਮੈਂ ਦੋ ਹਜ਼ਾਰ ਸਤਾਰਾਂ ਦੀ ਗੱਲ ਦੱਸ ਰਿਹਾ ਜਦ ਮੈਂ ਇੱਧਰ ਘੁੰਮ ਰਿਹਾ ਤਾ ਬਾਈਕ ਰਾਈਡ ਕਰ ਰਿਹਾ ਤਾ ਉਸ ਟਾਈਮ ਮੈਂ ਤੀਹ ਲੀਟਰ ਤੇਲ ਪਵਾਇਆ ਤਾ ਆਪਣੇ ਬਾਈਕ ਵਿੱਚ ਠਹਿਰ ਠਹਿਰ ਕੇ ਜਦੋਂ ਮੈਂ ਕ ਲੱਦਾਖ ਕਸ਼ਮੀਰ ਇਹ ਸਾਰਾ ਟੂਰ ਕੱਢਿਆ ਤਾ ਉਸ ਟਾਈਮ ਮੈਨੂੰ ਇਹ ਸਾਰਾ ਪਿਆ ਤਾ ਪੈਂਤੀ ਸੌ ਚਾਰ ਹਜ਼ਾਰ ਦਾ ਪਰ ਹੁਣ ਹੁਣ ਹੁਣ ਦੇ ਸਮੇਂ ਵਿੱਚ ਤੇਲ ਵਧਣ ਕਰਕੇ ਬਹੁਤ ਮੇਰੇ ਸ਼ੌਕ ਮਰ ਰਹੇ ਨੇ ਹੌਲੀ ਹੌਲੀ ਖਰਚੇ ਨਹੀਂ ਪੂਰੇ ਹੋ ਰਹੇ ਨੇ ਡੇ ਬਾਏ ਡੇ ਤੇਲ ਦਾ ਕਰਕੇ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਬਾਈਕ ਬਾਈਕ ਵਾਲਿਆਂ ਨੂੰ ਵੀ ਕਿਸੇ ਵੀ ਬਾਈਕ ਵਾਲੇ ਨੂੰ ਨਹੀਂ ਕਿਸੇ ਵੀ ਵਾਹਨ ਵਾਲਿਆਂ ਨੂੰ ਤੇਲ ਡੇ ਬਾਏ ਡੇ ਵਧੀ ਜਾ ਰਿਹਾ ਹੈ ਇੱਕ ਸੌ ਚਾਰ ਰੁਪਏ ਲੀਟਰ ਅੱਜ ਹੋ ਗਿਆ ਹੈ ਇਹ ਸ਼ੌਕ ਪੂਰੇ ਨਹੀਂ ਕਰ ਰਿਹਾ ਤੇਲ ਕੀਮਤਾਂ ਵਧਣ ਨਾਲ ਬਾਈਕ ਪ੍ਰਭਾਵਿਤ ਨੂੰ ਬਹੁਤ ਨੁਕ ਲੱਗਦਾ ਹੈ ਬਾਲਣ ਦੀ ਜ਼ਿਆਦਾ ਵਰਤੋਂ ਵਾਤਾਵਰਣ ਲਈ ਨੁਕਸਾਨਦੇਹ ਬਿਲਕੁਲ ਹੈ ਜੀ ਬਾਲਣ ਨਾ ਹੋਣ ਕਰਕੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਹਵਾ ਨਹੀਂ ਪਹਾੜ ਡੇ ਬਾਏ ਡੇ ਕੱਟੇ ਜਾ ਰਹੇ ਨੇ ਇਹ ਪਾਣੀ ਪ ਬਾਰਿਸ਼ ਬਾਰਿਸ਼ ਹੋਣ ਕਰਕੇ ਸਾਰੀ ਮਿੱਟੀ ਝੜ ਜਾਂਦੀ ਹੈ ਇੱਧਰ ਉੱਧਰ ਹੋ ਜਾਂਦੀ ਹੈ ਗਲ ਜਾਂਦੀ ਹੈ